ਹੈਲੋ ਓਲਾ ਓਲਾ ਕਾਰ ਵਾਲੇ ਬੋਲਦੇ ਆ ਬੇਟੇ ਹਾਂ ਤੁਹਾਡੇ ਕੋਲ ਕੋਈ ਗੱਡੀ ਵਿਹਲੀ ਹੈਗੀ ਐ ਅਸੀਂ ਬਠਿੰਡੇ ਤੋਂ ਬੋਲਦੇ ਹਾਂ ਬਠਿੰਡੇ ਤੋਂ ਸਰਸੇ ਜਾਣਾ ਹੈ ਰਸਤੇ 'ਚ ਰੁਕਣਾ ਵੀ ਹੈਗਾ ਲੱਗ ਜਾਣਗੇ ਪੰਦਰਾਂ ਵੀਹ ਮਿੰਟ ਰਸਤੇ ਉੱਥੇ ਕੋਈ ਕੋਈ ਕੰਮ ਔਰ ਉੱਥੇ ਕੰਮ ਹੋ ਕੇ ਜਾਣਾ ਫਿਰ ਫਰੂਟ ਵਗੈਰਾ ਦੁਕਾਨ ਤੋਂ ਸ਼ੋਪ ਤੋਂ ਸ਼ੋਪਿੰਗ ਕਰਨੀ ਹੈ ਠੀਕ ਹੈ ਅਤੇ ਸੁਬਹਾ ਆਉਣਾ ਵੀ ਹੈ ਅਸੀਂ ਸੁਬਹਾ ਚਾਰ ਵਜੇ ਜਲਦੀ ਆ ਜਾਓਗੇ ਤਾਂ ਦੱਸੋ ਅਤੇ ਕਿਰਾਇਆ ਕੀ ਲਓਗੇ ਜਾਣ ਦਾ ਕਿੰਨਾ ਆਉਣ ਦਾ ਕਿੰਨਾ ਇਹ ਸਾਨੂੰ ਸਹੀ ਦੱਸੋ ਜੇ ਕਿਤੇ ਤੁਹਾਡੇ ਕੋਲ ਕੋਈ ਗੱਡੀ ਹੈਗੀ ਹੈ ਸਾਨੂੰ ਦੱਸੋ ਜੇ ਨਹੀਂ ਹੈਗੀ ਤਾਂ ਦੱਸੋ ਲਾਰਾ ਤਾਂ ਲਾਇਓ ਨਾ ਹੈਂ ਤੁਹਾਡੀ ਝਾਕ ਦੇ ਵਿੱਚ ਅਸੀਂ ਕੋਈ ਹੋਰ ਵੀ ਨਾ ਟਰਾਈ ਮਾਰੀਏ ਅਤੇ ਕਿਤੇ ਇਹ ਨਾ ਹੋਵੇ ਵੀ ਅਸੀਂ ਤੁਹਾਨੂੰ ਬੁੱਕ ਕਰ ਲਈਏ ਤੁਸੀਂ ਆਓ ਨਾ ਆਉਣਾ ਜ਼ਰੂਰ ਪਊਗਾ ਲਾਰੇ ਤਾਂ ਲਾਇਓ ਨਾ ਫਿਰ ਸਾਨੂੰ ਕਿਰਾਇਆ ਦੱਸ ਦਿਓ ਆਉਣ ਜਾਣ ਦਾ ਕੀ ਲਓਗੇ ਸੁਬਹਾ ਸਾਨੂੰ ਚਾਹੀਦੇ ਤੁਸੀਂ ਚਾਰ ਵਜੇ ਚਾਰ ਤੋਂ ਲੇਟ ਨਾ ਹੋਇਓ